ਹੈਲੋ ਮੈਂ ਗੁਰਮੁਖ ਸਿੰਘ ਲੁਧਿਆਣੇ ਦਾ ਨਿਵਾਸੀ ਹਾਂ ਮੈਂ ਤੁਹਾਡੀ ਟੈਲੀਫੂਨ ਕੰਪਨੀ ਦਾ ਗਰਾਕ ਹਾਂ ਅਤੇ ਮੈਂ ਪਿਛਲੇ ਦਸ ਸਾਲਾਂ ਤੋਂ ਇਹ ਫੋਨ ਯੂਸ ਕਰ ਰਿਹਾ ਹਾਂ ਅਤੇ ਇਸ ਵਾਰ ਮੈਨੂੰ ਫੋਨ ਦੇ ਬਕਾਏ ਦੇ ਵਿੱਚ ਦਿੱਕਤ ਆਈ ਹੈ ਬਿੱਲ ਭਰਨ ਦੇ ਵਿੱਚ ਜੋ ਮੇਰਾ ਬਕਾਇਆ ਪੰਜ ਸੌ ਰੁਪਇਆ ਸੀ ਅਤੇ ਮੇਰਾ ਲੈਂਡਲਾਈਨ ਨੰਬਰ ਜੀਰੋ ਇੱਕ ਛੇ ਇੱਕ ਦੋ ਪੰਜ ਛੇ ਜੀਰੋ ਤਿੰਨ ਪੰਜ ਪੰਜ ਹੈ ਅਤੇ ਉਸਦੇ ਬਿੱਲ ਭਰਨ ਦੇ ਬਾਵਜੂਦ ਵੀ ਮੈਨੂੰ ਕਸਟਮਰ ਕੇਅਰ ਤੋਂ ਵਾਰ ਵਾਰ ਕਾਲ ਆ ਰਹੀ ਹੈ ਅਤੇ ਮੈਂ ਇਹ ਬਿੱਲ ਭਰ ਚੁੱਕਿਆਂ ਹਾਂ ਅਤੇ ਮੇਰੀ ਬੈਂਕ ਦੇ ਵਿੱਚੋਂ ਕਟੌਤੀ ਵੀ ਹੋ ਚੁੱਕੀ ਹੈ ਤਾਂ ਇਸ ਦੇ ਸੰਬੰਧ ਦੇ ਵਿੱਚ ਮੈਂ ਤੁਹਾਨੂੰ ਕਾਲ ਕੀਤੀ ਹੈ ਵੀ ਇਹ ਬਿੱਲ ਤੁਹਾਡੇ ਤੱਕ ਕਿਉਂ ਨਹੀਂ ਪਹੁੰਚਿਆ ਅਤੇ ਮੈਨੂੰ ਵਾਰ ਵਾਰ ਕਾਲਾਂ ਆ ਰਹੀਆਂ ਹਨ